ਸਾਡੇ ਤਰਨ ਤਾਰਨ ਜ਼ਿਲ੍ਹੇ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਸਥਾਨ ਹੈ ਜਿੱਥੇ ਕਿ ਸਰੋਵਰ ਬਹੁਤ ਵੱਡਾ ਹੈ ਸਾਰੇ ਪੰਜਾਬ ਦੇ ਵਿੱਚੋਂ ਸਾਰੇ ਇੰਡੀਆ ਦੇ ਵਿੱਚੋਂ ਇਹ ਸਰੋਵਰ ਵੱਡਾ ਹੈ ਲੋਕ ਇਸ ਨੂੰ ਵੇਖਣ ਵਾਸਤੇ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਆਉਂਦੇ ਆ ਇਹਨਾਂ ਦੇ ਨਾਲ ਹੀ ਇੱਕ ਥੋੜ੍ਹੀ ਦੂਰ ਦੂਰੀ 'ਤੇ ਝੂਲਣੇ ਮਹਿਲ ਆ ਜਿੱਥੇ ਕਿ ਜਾ ਕੇ ਆਪਾਂ ਉੱਥੇ ਬੈਠਦੇ ਹਾਂ ਕੰਧ ਉੱਪਰ ਜਾ ਕੇ ਬੈਠਦੇ ਹਾਂ ਅਤੇ ਉਹ ਜਦੋਂ ਬਾਬਾ ਜੀ ਅਰਦਾਸ ਕਰਦੇ ਆ ਤਾਂ ਫਿਰ ਉਹ ਕੰਧ 'ਤੇ ਝੂਲੇ ਆਉਂਦੇ ਆ ਇਹਨਾਂ ਤੋਂ ਇਲਾਵਾ ਹੋਰ ਵੀ ਬਾਬਾ ਬੋਤਾ ਸਿੰਘ ਬਾਬਾ ਗਰਜ਼ਾ ਸਿੰਘ ਜੀ ਦਾ ਸਥਾਨ ਹੈ ਜਿੱਥੇ ਕਿ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਆਉਂਦੀਆਂ ਨੇ ਉਹ ਦੇਖਦੇ ਨੇ ਕਿ ਇਸ ਸਥਾਨ 'ਤੇ ਦੋ ਸਿੰਘਾਂ ਨੇ ਕਿਵੇਂ ਇੰਨੀ ਵੱਡੀ ਮੁਗਲ ਫੌਜ ਦਾ ਟਾਕਰਾ ਕੀਤਾ